ਅੱਜ ਕੱਲ੍ਹ ਦੇ ਸਮੇਂ ਵਿੱਚ ਵਿਗਿਆਪਨ ਨੇ ਵਧੇਰੇ ਲੋਕਾਂ ਤੱਕ ਸੰਦੇਸ਼ ਜਾਂ ਕੋਈ ਵੀ ਇਨਫੋਰਮੇਸ਼ਨ ਭੇਜਣ ਲਈ ਕਈ ਪ੍ਰਕਾਰ ਦੇ ਸੋਰਸ ਲੱਭ ਲਏ ਹਨ ਜਿਵੇਂ ਕਿ ਸ਼ੋਸ਼ਲ ਮੀਡੀਆ ਅਖ਼ਬਾਰ ਮੈਗਜ਼ੀਨ ਅਤੇ ਕੋਈ ਹੋਰ ਤਰ੍ਹਾਂ ਦੇ ਇਸ਼ਤਿਹਾਰ ਇਸ ਤੋਂ ਸਿਵਾ ਔਨਲਾਈਨ ਨਿਊਜ਼ ਡੇਲੀ ਅਪਡੇਟਸ ਫ਼ੋਨ ਉੱਤੇ ਵੀ ਆ ਜਾਂਦੇ ਹਨ ਮੈਂ ਇੱਥੇ ਇੱਕ ਅਜਿਹੇ ਇਸ਼ਤਿਹਾਰ ਦੀ ਗੱਲ ਕਰਨਾ ਚਾਹਾਂਗਾ ਜੋ ਪ੍ਰਿੰਟਿੰਗ ਮੀਡੀਆ ਅਖ਼ਬਾਰ ਉੱਤੇ ਰੋਜ਼ ਦੇਖਦਾ ਹਾਂ ਅਤੇ ਪ੍ਰਭਾਵਸ਼ਾਲੀ ਲੱਗਦਾ ਹੈ ਬਹੁਤ ਇਹ ਇੱਕ ਅਜਿਹਾ ਪਾਰਟ ਹੈ ਜੋ ਕਿ ਕਹਾਣੀਆਂ ਹੁੰਦੀਆਂ ਹਨ ਪਰ ਇਹ ਚਿੱਤਰ ਦੇ ਰਾਹੀ ਜਾਂ ਫੋਟੋਆਂ ਦੇ ਰਾਹੀਂ ਦਰਸਾਇਆ ਜਾਂਦੀਆਂ ਹਨ ਅਤੇ ਇਹ ਬੱਚਿਆਂ ਅਤੇ ਵੱਡਿਆਂ ਨੂੰ ਦੋਵਾਂ ਵਰਗ ਦੇ ਵਿਅਕਤੀਆਂ ਨੂੰ ਬਹੁਤ ਵਧੀਆ ਲੱਗਦੀਆਂ ਹਨ ਕਾਰਟੂਨ ਦੀ ਮਦਦ ਨਾਲ ਸਟੋਰੀ ਨੂੰ ਦਰਸਾਇਆ ਜਾਂਦਾ ਹੈ ਪਰ ਹਰ ਇੱਕ ਕਹਾਣੀ ਇੱਕ ਮੋਰਸਲ ਜ਼ਰੂਰ ਹੁੰਦੀ ਹੈ ਜੋ ਕਿ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਅਤੇ ਅਹਿਮ ਭੂਮਿਕਾ ਨਿਭਾਉਂਦੀ ਹੈ ਇਹ ਹਿੱਸਾ ਮੈਨੂੰ ਪੜ੍ਹਨ ਲਈ ਬਹੁਤ ਮਜ਼ੇਦਾਰ ਲੱਗਦਾ ਹੈ